ਭੰਗੜਾ ਪੰਜਾਬ ਦਾ ਇੱਕ ਅਜਿਹਾ ਲੋਕ ਨਾਚ ਹੈ ਜਿਹਦੇ ਵਿੱਚ ਕਾਫ਼ੀ ਲੋਕ ਇਸ ਚੀਜ਼ ਨੂੰ ਆਪਣਾ ਦਿਲ ਦਾ ਨਾਚ ਵੀ ਕਹਿੰਦੇ ਹਨ ਭੰਗੜਾ ਇੱਕ ਢੋਲ ਦੇ ਨਾਲ ਪਾਇਆ ਜਾਂਦਾ ਹੈ ਕਦੀ ਕਦੀ ਭੰਗੜਾ ਡੀ ਜੇ ਦੀਆਂ ਬੀਟਾਂ 'ਤੇ ਵੀ ਪਾਇਆ ਜਾਂਦਾ ਹੈ ਐਕਰੋਬਿਕਸ ਵੀ ਇਹੋ ਜਿਹੀ ਚੀਜ਼ ਹੈ ਜਿਹਦੇ ਵਿੱਚ ਇੱਕ ਇਨਸਾਨ ਆਪਣੀ ਬੋਡੀ ਨੂੰ ਫਿੱਟ ਰੱਖਦਾ ਹੈ ਐਕਰੋਬੈਕਸ ਵੀ ਜਿਮ 'ਚ ਵੀ ਕਰ ਸਕਦਾ ਹੈ ਅਤੇ ਜਦੋਂ ਵੀ ਉਹਨੂੰ ਸਮਾਂ ਮਿਲੇ ਉਦੋਂ ਕਰ ਸਕਦਾ ਹੈ ਭੰਗੜਾ ਵਿਆਹ ਸ਼ਾਦੀਆਂ 'ਤੇ ਪਾਇਆ ਜਾਣ ਵਾਲਾ ਪੰਜਾਬ ਵਿੱਚ ਬੜਾ ਕੋਮਨ ਜਿਹਾ ਨਾਚ ਹੈ ਲੋਕ ਭੰਗੜਾ ਪਾ ਕੇ ਆਪਣੀ ਖੁਸ਼ੀ ਇਜ਼ਹਾਰ ਕਰਦੇ ਹਨ ਅਤੇ ਕਈ ਕਈ ਵਾਰ ਇਹ ਭੰਗੜਾ ਲੋਕਾਂ ਦੇ ਪੈਸੇ ਕਮਾਉਣ ਦਾ ਵੀ ਜ਼ਰੀਆ ਹੈ ਭੰਗੜਾ ਸਿਖਾ ਕੇ ਲੋਕ ਪੈਸੇ ਲੈਂਦੇ ਹਨ ਅਤੇ ਬੱਚਿਆਂ ਨੂੰ ਯੂਥ ਫੈਸਟੀਵਲ ਵੀ ਕਰਵਾਉਂਦੇ ਹਨ ਅਕਰੋਬੈਕਸ ਵ ਨਾਲ ਨਾਲ ਸਾਡੇ ਖੂਨ ਦਾ ਫਲੋ ਵੱਧਦਾ ਹੈ ਅਤੇ ਨਾਲ ਨਾਲ ਅਸੀਂ ਆਪਣੀ ਬੋਡੀ ਨੂੰ ਫਿੱਟ ਰੱਖਦੇ ਹਨ